ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੇ ਦੇਸ਼ ਵਿੱਚ ਵੱਖ ਵੱਖ ਤਿਉਹਾਰ ਮਨਾਏ ਜਾਂਦੇ ਹਨ ਉਹਨਾਂ ਤਿਉਹਾਰਾਂ ਦੇ ਮੁਤਾਬਿਕ ਹੀ ਆਪਾਂ ਘਰ ਵਿੱਚ ਬਹੁਤ ਹੀ ਵਧੀਆ ਪਕਵਾਨ ਬਣਾਉਂਦੇ ਹਾਂ ਜਿਵੇਂ ਕਿ ਆਪਾਂ ਗੱਲ ਕਰੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀ ਉਸ ਸਮੇਂ ਆਪਾਂ ਦਾਲ ਰੋਟੀ ਪਨੀਰ ਦੀ ਸਬਜ਼ੀ ਖੀਰ ਕੜਾਹ ਆਦਿ ਤਿਆਰ ਕਰਦੇ ਹਾਂ ਜੇ ਆਪਾਂ ਗੱਲ ਕਰੀਏ ਤਿਉਹਾਰ ਦਿਵਾਲੀ ਦੀ ਦਿਵਾਲੀ ਦੀ ਸਮੇਂ ਆਪਾਂ ਘਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਮਠਿਆਈਆਂ ਪਕੌੜੇ ਜਿਵੇਂ ਪਕੌੜੇ ਕਈ ਤਰ੍ਹਾਂ ਦੇ ਪਕਵਾਨ ਨੂੰ ਆਪਾਂ ਤਿਆਰ ਕਰਦੇ ਹਾਂ ਜੋ ਕਿ ਆਪਾਂ ਬਹੁਤ ਜ਼ਿਆਦਾ ਖਾਣਾ ਵੀ ਪਸੰਦ ਕਰਦੇ ਹਾਂ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਮਿਕਸ ਸਬਜ਼ੀ ਸਾਗ ਮੱਕੀ ਦੀ ਰੋਟੀ ਜਿਵੇਂ ਕਿ ਦਿਵਾਲੀ ਸਿਆਲ ਦਾ ਪ੍ਰਸਿੱਧ ਤਿਉਹਾਰ ਹੈ ਤਿਉਹਾਰਾਂ ਦੇ ਮੁਤਾਬਿਕ ਹੀ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਲੋਹੜੀ ਦੇ ਤਿਉਹਾਰ ਦੇ ਸਮੇਂ ਰੋਹ ਵਾਲੀ ਖੀਰ ਅਤੇ ਖਿਚੜੀ ਨੂੰ ਸਭ ਤੋਂ ਪ੍ਰਸਿੱਧ ਮੰਨਿਆ ਜਾਂਦਾ ਹੈ ਜੋ ਕਿ ਆਪਾਂ ਘਰ ਵਿੱਚ ਬਣਾਉਣਾ ਹੀ ਪਸੰਦ ਕਰਦੇ ਹਾਂ ਜਿਵੇਂ ਕਿ ਰੋਹ ਵਾਲੀ ਖੀਰ ਵਿੱਚ ਕਈ ਤਰ੍ਹਾਂ ਦੇ ਚਾਵਲ ਫਿਰ ਰੋਹ ਨੂੰ ਬਣਾ ਕੇ ਤਿਆਰ ਕੀਤਾ ਜਾਂਦਾ